ਯੋਗਾ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੈ ਇਹ ਸਾਨੂੰ ਛੋਟੇ ਹੁੰਦੇ ਤੋਂ ਹੀ ਬਚਪਨ ਤੋਂ ਹੀ ਯੋਗਾ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਇਹ ਛੋਟੇ ਹੁੰਦਿਆਂ ਸਾਡਾ ਸਰੀਰ ਬਹੁਤ ਹੀ ਫਲੈਕਸੀਬਲ ਹੁੰਦਾ ਹੈ ਇਸ ਕਰਕੇ ਆਪਾਂ ਛੋਟੇ ਹੁੰਦੇ ਤੋਂ ਹੀ ਯੋਗਾ ਨੂੰ ਕਰ ਸਕਦੇ ਹਨ ਅਤੇ ਇਹ ਸਾਡੇ ਕਿ ਵੱਡੇ ਬਜ਼ੁਰਗਾਂ ਵਾਸਤੇ ਵੀ ਬਹੁਤ ਵਧੀਆ ਹੈ ਕਿਉਂਕਿ ਜਿਵੇਂ ਕਿ ਉਹਨਾਂ ਦੇ ਗੋਡੇ ਵਗੈਰਾ ਦੁੱਖਦੇ ਹਨ ਅਤੇ ਇਸੇ ਤਰ੍ਹਾਂ ਉਹ ਉਹਨਾਂ ਦੇ ਯੋਗਾ ਕਰਨ ਨਾਲ ਵੋ ਸਰੀਰ ਚਲਦਾ ਰਹਿੰਦਾ ਹੈ ਕਿਉਂਕਿ ਉਹਨਾਂ ਦਾ ਜਿਹੜਾ ਸਰੀਰ ਜੋ ਹੈ ਕਿ ਉਮਰ ਦੇ ਹਿਸਾਬ ਨਾਲ ਉਹਨਾਂ ਦੀ ਉਮਰ ਘੱਟਦੀ ਰਹਿੰਦੀ ਹੈ ਜੋ ਕਿ ਉਹ ਬੈਡ ਜੋਗੇ ਹੋ ਜਾਂਦੇ ਹਨ ਇਸੇ ਤਰ੍ਹਾਂ ਉਹਨਾਂ ਨੂੰ ਯੋਗਾ ਕਰਨੀ ਰਹਿਣੀ ਚਾਹੀਦੀ ਹੈ ਜੋ ਕਿ ਉਹਨਾਂ ਦਾ ਸਰੀਰ ਚੱਲਦਾ ਰਹਿਣਾ ਚਾਹੀਦਾ ਹੈ ਇਸੇ ਕਰਕੇ ਹੁਣ ਜੋ ਕਿ ਸਾਡੇ ਛੋਟੇ ਛੋਟੇ ਉਮਰ ਵਿੱਚ ਬੱਚੇ ਹਨ ਉਹਨਾਂ ਨੂੰ ਅਤੇ ਇਹ ਯੋਗ ਉਹਨਾਂ ਵਾਸਤੇ ਬਹੁਤ ਹੀ ਲਾਭਕਾਰੀ ਹੈ ਕਿਉਂਕਿ ਬੱਚੇ ਜਿਹੜੇ ਹਨ ਉਹ ਛੋਟੇ ਹੁੰਦੇ ਤੋਂ ਹੀ ਜੇਕਰ ਯੋਗਾ ਦੇ ਆਦੀ ਹੋ ਜਾਣਗੇ ਤਾਂ ਉਹ ਹ ਹੌਲੀ ਹੌਲੀ ਆਪਣੇ ਯੋਗ ਨੂੰ ਵਧਾ ਵੀ ਸਕਣਗੇ ਜਿਸ ਕਰਕੇ ਉਹਨਾਂ ਦੀ ਜਿਹੜੀ ਉਮਰ ਹੈ ਹੌਲੀ ਹੌਲੀ ਕ ਕਾਫੀ ਵੱਧ ਸਕਦੀ ਹੈ ਕਿਉਂਕਿ ਵੱਡੇ ਬਜ਼ੁਰਗਾਂ ਵਾਸਤੇ ਤਾਂ ਇਹ ਇਹ ਇੱਕ ਲਾਭਦਾਇਕ ਚੀਜ਼ ਹੈ ਹੀ ਹੈ ਇਸੇ ਕਰਕੇ ਜੋ ਕਿ ਬੱਚੇ ਛੋਟੇ ਹੁੰਦੇ ਤੋਂ ਇਸ ਨੂੰ ਚੀਜ਼ ਨੂੰ ਕਰਦੇ ਆ ਰਹੇ ਹਨ ਅਤੇ ਉਹ ਹੌਲੀ ਹੌਲੀ ਇਸ ਨੂੰ ਵਧਾ ਵੀ ਸਕਦੇ ਹਨ ਤਾਂ ਕਿ ਯੋਗ ਯੋਗਾ ਸਾਡੇ ਸਰੀਰ ਵਾਸਤੇ ਬ ਵਧੀਆ ਬਹੁਤ ਹੈ ਇਸ ਕਰਕੇ ਸਾਨੂੰ ਯੋਗਾ ਨੂੰ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਵੱਡੇ ਬਜ਼ੁਰਗ ਜਿਹੜੇ ਹੁੰਦੇ ਹਨ ਉਹਨਾਂ ਦੇ ਗੋਡੇ ਵਗੈਰਾ ਜੁੜ ਜਾਂਦੇ ਹਨ ਇਸ ਕਰਕੇ ਉਹਨਾਂ ਨੂੰ ਯੋਗਾ ਕਰਦੇ ਰਹਿਣੀ ਚਾਹੀਦੀ ਹੈ ਅਤੇ ਛੋਟੇ ਬੱਚਿਆਂ ਨੂੰ ਵੀ ਯੋਗਾ ਦਾ ਇਸਤੇਮਾਲ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਸਾਡਾ ਜੋ ਕਿ ਇਹ ਬੋਡੀ ਦੀ ਇਮਉਨਿਟੀ ਹੈ ਉਹ ਬਹੁਤ ਹੀ ਵਧੀਆ ਚਲਦੀ ਰਹਿੰਦੀ ਹਨ ਮੈਂ ਛੋਟੇ ਹੁੰਦੇ ਤੋਂ ਹੀ ਯੋਗਾ ਦੇ ਯੋਗ ਵਿੱਚ ਚੱਲਦਾ ਰਿਹਾ ਹਾਂ ਇਸ ਕਰਕੇ ਮੈਂ ਯੋਗਾ ਕਰਦਾ ਰਿਹਾ ਹਾਂ